ਹਾਂਜੀ ਦੋਸਤੋ ਮੈਂ ਅੱਜ ਤੁਹਾਡੇ ਨਾਲ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਹੀ ਐਕਸਪੀਰੀਅਨਸ ਜਿਹੜਾ ਹੈਗਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਕਿ ਜਦੋਂ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਪ੍ਰਾਪਤੀ ਕਰਦੇ ਹੋ ਤਾਂ ਤੁਹਾਨੂੰ ਉਸ ਚੀਜ਼ 'ਤੇ ਮਾਣ ਹੁੰਦਾ ਹੈ ਮੈਂ ਵੈਸੇ ਤਾਂ ਪਹਿਲੇ ਮਤਲਬ ਬਹੁਤ ਜ਼ਿਆਦਾ ਕਾਬਿਲ ਸੀ ਮੈਨੂੰ ਲੱਗਦਾ ਸੀ ਕਿ ਮੈਂ ਬਹੁਤ ਕੁਛ ਐਸਾ ਮਤਲਬ ਪ੍ਰਾਪਤ ਕਰ ਸਕਦੀ ਹਾਂ ਜੋ ਕਿ ਮੈਂ ਕਰ ਸਕਦੀ ਸੀ ਲੇਕਿਨ ਇੱਕ ਟਾਈਮ ਐਸਾ ਆਇਆ ਕਿ ਜਦੋਂ ਮੈਂ ਬਿਲਕੁਲ ਲਾਚਾਰ ਹੋ ਗਈ ਔਰ ਮੈਨੂੰ ਲੱਗਿਆ ਕਿ ਮੈਂ ਹੁਣ ਕੁਛ ਵੀ ਨਹੀਂ ਕਰ ਸਕਦੀ ਲੇਕਿਨ ਆਪਣੇ ਉਸ ਲਾਚਾਰੀ ਦੇ ਬਾਵਜੂਦ ਮੈਂ ਫਿਰ ਵੀ ਮਤਲਬ ਆਪਣੀ ਜਿਹੜੀ ਹੈਗੀ ਆ ਪੜ੍ਹਾਈ ਉਸ ਨੂੰ ਜਾਰੀ ਰੱਖਿਆ ਔਰ ਉਸ ਦੇ ਵਿੱਚ ਮੈਂ ਅੱਛੇ ਜਿਹੜੇ ਹੈਗੇ ਆ ਅੰਕ ਪ੍ਰਾਪਤ ਕਰਕੇ ਅੱਜ ਇੱਕ ਮਤਲਬ ਚੰਗੀ ਮੈਂ ਇੱਕ ਪੜ੍ਹਾਈ ਜਿਹੜੀ ਹੈਗੀ ਆ ਹਾਸਿਲ ਕਰੀ ਹੈ ਅੱਜ ਬੇਸ਼ੱਕ ਮੈਂ ਐੱਮਏ ਬੀਐੱਡ ਕੀਤੀ ਹੈ ਔਰ ਮੈਂ ਇੱਕ ਸਕੂਲ ਦੇ ਵਿੱਚ ਹੀ ਇੱਕ ਅੱਜ ਅਧਿਆਪਕ ਹਾਂ ਅਤੇ ਇਸ ਗੱਲ 'ਤੇ ਮੈਨੂੰ ਬਹੁਤ ਜ਼ਿਆਦਾ ਹੈਗਾ ਆਪਣੇ 'ਤੇ ਮਾਣ ਹੈ